ਨਵੇਂ ਜੰਮੇ ਬੱਚੇ ਦੀਆਂ ਕਈ ਰਸਮਾਂ ਕੀਤੀਆਂ ਜਾਂਦੀਆਂ ਜਿੱਦਾਂ ਕਿ ਮੇਰੇ ਆਪਣੇ ਦੋ ਬੱਚੇ ਹਨ ਇੱਕ ਕੁੜੀ ਅਤੇ ਇੱਕ ਮੁੰਡਾ ਮੈਂ ਉਹਨਾਂ ਨੂੰ ਉਹਨਾਂ ਦੇ ਪਹਿਲੇ ਸਾਲ ਦੇ ਵਿੱਚ ਜਿਹੜੀਆਂ ਜਿਹੜੀਆਂ ਵੀ ਰਸਮਾਂ ਕੀਤੀਆਂ ਸੀਗੀਆਂ ਉਹ ਮੈਨੂੰ ਅੱਛੀ ਤਰ੍ਹਾਂ ਯਾਦ ਨੇ ਜਿੱਦਾਂ ਕਿ ਪਹਿਲੇ ਹੀ ਦਿਨ ਜਦੋਂ ਮੇਰੀ ਪਹਿਲੇ ਬੇਟੀ ਹੋਈ ਸੀ ਅਤੇ ਉਹਦੇ ਵਿੱਚ ਅਸੀਂ ਪਹਿਲੇ ਉਹਨੂੰ ਗੁੜ੍ਹਤੀ ਦੀ ਅਗਲੇ ਦਿਨ ਸਭ ਤੋਂ ਪਹਿਲੇ ਆਪਾਂ ਉਹਨੂੰ ਗੁੜ੍ਹਤੀ ਦਿੱਤੀ ਫਿਰ ਉਹ ਤੋਂ ਬਾਅਦ ਉਹਦੇ ਪਹਿਲੇ ਤੇਰ੍ਹਵੇਂ ਦੇ ਚੌਂਕਾ ਚੜ੍ਹਾਇਆ ਜਾਂਦਾ ਹੈ ਫਿਰ ਉਸ ਦੇ ਬਾਅਦ ਇੱਕ ਸਵਾ ਮਹੀਨੇ ਤੋਂ ਬਾਅਦ ਬੱਚਾ ਕਦੀ ਵੀ ਘ ਘਰ ਤੋਂ ਬਾਹਰ ਜਾਣ ਸਕਦਾ ਹੈ ਕਿਉਂਕਿ ਉਸ ਤੋਂ ਪਹਿਲੇ ਅਸੀਂ ਸਮਝਦੇ ਹਾਂ ਕਿ ਸਵਾ ਮਹੀਨੇ ਤੋਂ ਪਹਿਲੇ ਕਦੀ ਬਾਹਰ ਨਹੀਂ ਜਾਣਾ ਚਾਹੀਦਾ ਫਿਰ ਉਸ ਦੌਰਾਨ ਜੇ ਕਦੀ ਇੱਕ ਸਾਲ ਦੇ ਵਿੱਚ ਵਿੱਚ ਕਦੀ ਪਹਿਲੇ ਦਿਵਾਲੀ ਦਾ ਤਿਉਹਾਰ ਆ ਜਾਂਦਾ ਹੈ ਤਾਂ ਉਸਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਅਸੀਂ ਇਸ ਨੂੰ ਮਨਾਉਂਦੇ ਹਾਂ ਕਿ ਬੱਚੇ ਦੀ ਪਹਿਲੀ ਦਿਵਾਲੀ ਹੈ ਇਸ ਤਰ੍ਹਾਂ ਹੋਰ ਵੀ ਜਿਹੜੇ ਵੀ ਤਿਉਹਾਰ ਉਸ ਦੇ ਪਹਿਲੇ ਸਾਲ ਦੇ ਦੌਰਾਨ ਆਉਂਦੇ ਹਨ ਉਹ ਆਪਾਂ ਬੜੇ ਹੀ ਚਾਵਾਂ ਦੇ ਨਾਲ ਕਰਦੇ ਹਾਂ ਅਤੇ ਇਸ ਤਰ੍ਹਾਂ ਅਸੀਂ ਹੋਰ ਵੀ ਬਹੁਤ ਜ਼ਿਆਦਾ ਰਸਮਾਂ ਕਰਦੇ ਹਾਂ ਜੋ ਕਿ ਇੱਕ ਸਾਲ ਦੇ ਵਿੱਚ ਆਉਂਦੀਆਂ ਹਨ ਧੰਨਵਾਦ